ਨੈੱਟਫਲਿਕਸ ਐਮਾਜ਼ੋਨ ਪ੍ਰਾਈਮ ਵੀਡੀਓ ਡਿਜ਼ਨੀ ਪਲਸ ਹੋਟ ਸਟਾਰ ਆਦਿ ਵਰਗੀ ਸਟ੍ਰੀਮਿੰਗ ਸੇਵਾਵਾਂ ਨੇ ਪਿਛਲੇ ਕੁਛ ਸਾਲਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧੀ ਹਾਸਿਲ ਕੀਤੀ ਹੈ ਇਹ ਸੇਵਾਵਾਂ ਵਿਭਿੰਨ ਸਮੱਗਰੀ ਜਿਵੇਂ ਕਿ ਫਿਲਮਾਂ ਟੀ ਵੀ ਸ਼ੋਅ ਡੋਕੋਮੈਂਟਰੀ ਅਤੇ ਹੋਰ ਬਹੁਤ ਕੁਛ ਨੂੰ ਔਨਲਾਈਨ ਦੇਖਣ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ ਨ ਉਪਭੋਗਤਾਵਾਂ ਆਪਣੀ ਸਹੂਲਤ ਅਨੁਸਾਰ ਸਟ੍ਰੀਮਿੰਗ ਕਰ ਸਕਦੇ ਹਨ ਅਤੇ ਕਿਸੇ ਵੀ ਸਮੇਂ 'ਤੇ ਕੋਈ ਵੀ ਸਮੱਗਰੀ ਦੇਖ ਸਕਦੇ ਹਨ ਇਹਨਾਂ ਨੇ ਕੇਵਲ ਸੈਟਾਲਾਈਟ ਟੀ ਵੀ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ ਠੀਕ ਰਵਾਇਤੀ ਕੇਵਲ ਜਾਂ ਸੈਟਾਲਾਈਟ ਟੀ ਵੀ ਨਾਲ ਤੁਲਨਾ ਕੀਤੀ ਜਾਵੇ ਤਾਂ ਸਟ੍ਰੀਮਿੰਗ ਸੇਵਾਵਾਂ ਦੇ ਬਹੁਤ ਸਾਰੇ ਫ਼ਾਇਦੇ ਹਨ ਪਹਿਲਾ ਅਤੇ ਸਭ ਤੋਂ ਵੱਡਾ ਫ਼ਾਇਦਾ ਹੈ ਸਮੇਂ ਦੀ ਸੁਤੰਤਰਤਾ ਸਟ੍ਰੀਮਿੰਗ ਸੇਵਾਵਾਂ ਨਾਲ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਸਥਾਨ 'ਤੇ ਆਪਣੀ ਮਨਪਸੰਦ ਸਮੱਗਰੀ ਦੇਖ ਸਕਦੇ ਹੋ ਤੁਹਾਨੂੰ ਪ੍ਰੋਗਰਾਮ ਦੇ ਆਉਣ ਦੀ ਉਡੀਕ ਨਹੀਂ ਕਰਨੀ ਪੈਂਦੀ ਇਸ ਦੇ ਨਾਲ ਆਪਣੇ ਸਮੇਂ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ ਆਪਾਂ ਜਦੋਂ ਵੀ ਫ੍ਰੀ ਹੁੰਦੇ ਹਾਂ ਤਾਂ ਉਦੋਂ ਕੋਈ ਵੀ ਪ੍ਰੋਗਰਾਮ ਲਗਾ ਕੇ ਦੇਖ ਸਕਦੇ ਹਾਂ ਜਦੋਂ ਕਿ ਕੇਵਲ ਜਾਂ ਸੈਟਾਲਾਈਟ ਵਿੱਚ ਕੁਛ ਵੀ ਦੇਖਣ ਲਈ ਆਪਾਂ ਨੂੰ ਉਸ ਇੱਕ ਸ ਪਾਬੰਦ ਸਮੇਂ 'ਤੇ ਦੇਖਣਾ ਪੈਂਦਾ ਸੀਗਾ ਕਈ ਵਾਰ ਆਪਾਂ ਬਿਜ਼ੀ ਹੁੰਦੇ ਹਾਂ ਤਾਂ ਉਹ ਵੀ ਟਾਈਮ ਆਪਾਂ ਨਹੀਂ ਦੇਖ ਪਾਉਂਦੇ ਦੂਜਾ ਮੁੱਖ ਫ਼ਾਇਦਾ ਹੈ ਸਮੱਗਰੀ ਦੀ ਵਿਭਿੰਤਾ ਨੈੱਟਫਲਿਕਸ ਪ੍ਰਾਈਮ ਵੀਡੀਓ ਅਤੇ ਹੋਰ ਸੇਵਾਵਾਂ ਵੱਖ ਵੱਖ ਸ਼ੈਲੀਆਂ ਦੀ ਸਮੱਗਰੀ ਪ੍ਰਧਾਨ ਕਰਦੀਆਂ ਹਨ ਤੁਹਾਨੂੰ ਐਕਸ਼ਨ ਰਮੈਂਸ ਡਰਾਮਾ ਕਮੇਡੀ ਸਾਇੰਸ ਫਿਕਸ਼ਨ ਅਤੇ ਹੋਰ ਕਿਸੇ ਵੀ ਸ਼ੈਲੀ ਦੀ ਫਿਲਮ ਜਾਂ ਟੀ ਵੀ ਸ਼ੋਅ ਮਿਲ ਸਕਦੀ ਹੈ ਇਹ ਸੇਵਾਵਾਂ ਗਲੋਬਲ ਅਤੋ ਲੋਕਲ ਦੋਨੋਂ ਕਿਸਮ ਦੀ ਸਮੱਗਰੀ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਉਪਭੋਗਤਾਵਾਂ ਨੂੰ ਵੱਖ ਵੱਖ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੀ ਸਮੱਗਰੀ ਦੇਖਣ ਨੂੰ ਮਿਲਦੀ ਹੈ ਤੀਜਾ ਫ਼ਾਇਦਾ ਇਸਦਾ ਹੈ ਸਟ੍ਰੀਮਿੰਗ ਸੇਵਾਵਾਂ ਵਿੱਚ ਪੈਸੇ ਦੀ ਬੱਚਤ ਵੀ ਬਹੁਤ ਹੁੰਦੀ ਹੈ ਬਹੁਤ ਸਾਰੀਆਂ ਸੇਵਾਵਾਂ ਸਸਤੀ ਮਹੀਨਾ ਵਾਰ ਫੀਸ ਦੇ ਨਾਲ ਆਉਂਦੀਆਂ ਹਨ ਜੋ ਕਿ ਰਵਾਇਤੀ ਕੇਵਲ ਸਬਸਕ੍ਰਿਪਸ਼ਨ ਨਾਲੋਂ ਕਾਫ਼ੀ ਸਸਤੀ ਹੁੰਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਐਡਸ ਦੇਖਣ ਦੀ ਲੋੜ ਵੀ ਨਹੀਂ ਪੈਂਦੀ ਜੋ ਕਿ ਟੀ ਵੀ ਦੇਖਣ ਦਾ ਸਧਾਰਨ ਹਿੱਸਾ ਹੁੰਦਾ ਹੈ ਅੱਜ ਕੱਲ੍ਹ ਤਾਂ ਐਡਸ ਵੀ ਪੰਦਰ੍ਹਾਂ ਪੰਦਰ੍ਹਾਂ ਮਿੰਟਾਂ ਦੀਆਂ ਆਉਣ ਲੱਗ ਪਈਆਂ ਹਨ ਹਾਲਾਂਕਿ ਸਟ੍ਰੀਮਿੰਗ ਸੇਵਾਵਾਂ ਦੇ ਕੁਛ ਨੁਕਸਾਨ ਵੀ ਹਨ ਸਭ ਤੋਂ ਵੱਡਾ ਨੁਕਸਾਨ ਹੈ ਇੰਟਰਨੈੱਟ ਦੀ ਲੋੜ ਤੁਹਾਨੂੰ ਇੱਕ ਸਥਿਰ ਅਤੇ ਤੇਜ਼ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੁੰਦੀ ਹੈ ਜਦੋਂ ਸਾਡੇ ਕੋਲ ਚੰਗਾ ਇੰਟਰਕਨੈੱਟ ਕਨੈਕਸ਼ਨ ਨਹੀਂ ਹੈ ਤਾਂ ਤੁਸੀਂ ਸਮੱਗਰੀ ਨੂੰ ਵਧੀਆ ਗੁਣਵੱਤਾ ਵਿੱਚ ਨਹੀਂ ਦੇਖ ਸਕਦੇ ਇਸ ਦੇ ਬਾਵਜੂਦ ਸਟ੍ਰੀਮਿੰਗ ਸੇਵਾਵਾਂ ਨੇ ਮੌਜੂਦਾ ਦੌਰ ਵਿੱਚ ਮਨ ਮਨੋਰੰਜਨ ਦੇਖਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ ਉਪਭੋਗਤਾ ਹੁਣ ਆਪਣੀ ਮਰਜ਼ੀ ਨਾਲ ਆਪਣੇ ਸਮੇਂ 'ਤੇ ਆਪਣੇ ਪਸੰਦ ਦੀ ਸਮੱਗਰੀ ਦਾ ਆਨੰਦ ਲੈ ਸਕਦੇ ਹਨ ਕੋਈ ਵੀ ਨਵੀਂ ਫਿਲਮ ਆਉਂਦੀ ਹੈ ਤਾਂ ਅਸੀਂ ਉਸਨੂੰ ਸਟ੍ਰੀਮਿੰਗ 'ਤੇ ਦੇਖ ਸਕਦੇ ਹਾਂ ਜੋ ਕਿ ਅਗਰ ਆਪਾਂ ਕਿਸੇ ਵੀ ਮੋਲ ਵਿੱਚ ਦੇਖਣ ਜਾਂਦੇ ਹਾਂ ਤਾਂ ਉਸ ਦੀ ਟਿਕਟ ਬਹੁਤ ਮਹਿੰਗੀ ਹੁੰਦੀ ਹੈ ਜੋ ਕਿ ਹਰ ਇੱਕ ਬੰਦਾ ਨਹੀਂ ਪੇਅ ਅਫੋਰਡ ਕਰ ਪਾਉਂਦਾ ਤਾਂ ਕਰਕੇ ਇਹਨਾਂ ਦੇ ਫ਼ਾਇਦੇ ਵੀ ਹੈ ਤਾਂ ਇਸ ਦੇ ਨਾਲ ਨਾਲ ਨੁਕਸਾਨ ਵੀ ਹੈ ਬਟ ਸਭ ਤੋਂ ਵੱਡੇ ਪਰ ਆਪਾਂ ਜੇ ਦੇਖੀਏ ਤਾਂ ਅੱਜ ਕੱਲ੍ਹ ਹਰ ਕੋਈ ਇਹ ਹੀ ਯੂਜ ਕਰਦਾ ਹੈ ਤਾਂ ਕਰਕੇ ਆਪਾਂ ਇਸ ਨੂੰ ਫ਼ਾਇਦੇ ਵੱਲ ਹੀ ਦੇਖਣਾ ਚਾਹਵਾਂਗੇ ਬਾਕੀ ਹਰ ਇੱਕ ਚੀਜ਼ ਦੇ ਨੁਕਸਾਨ ਤਾਂ ਹੁੰਦੇ ਹੀ ਹੈ ਬਟ ਅੰਤ ਵਿੱਚ ਇਹ ਹੀ ਕਹਿਣਾ ਚਾਹਵਾਂਗੀ ਕਿ ਨੈੱਟਫਲਿਕਸ ਅਤੇ ਪ੍ਰਾਈਮ ਸਟ੍ਰੀਮ ਦੀ ਵਰਤੋਂ ਚੰਗੀ ਥਾਵਾਂ 'ਤੇ ਹੀ ਕੀਤੀ ਜਾਵੇ